ਸਾਡੇ ਇਲਾਕੇ ਵਿੱਚ ਲੋਕ ਜ਼ਿਆਦਾਤਰ ਠੰਡੀਆਂ ਥਾਵਾਂ 'ਤੇ ਜਾਣ ਦੀ ਯਾਤਰਾ ਪਸੰਦ ਕਰਦੇ ਹਨ ਕਿਉਂਕਿ ਸਾਡੇ ਰੋਪੜ ਇਲਾਕੇ ਵਿੱਚ ਗਰਮੀ ਦਾ ਕਹਿਰ ਜੋ ਪੈ ਰਿਹਾ ਹੈ ਉਸ ਕਰਕੇ ਲੋਕ ਕਈ ਲੋਕਾਂ ਤੋਂ ਗਰਮੀ ਜ਼ਿਆਦਾ ਨਹੀਂ ਝੱਲ ਹੁੰਦੀ ਅਤੇ ਉਹ ਹਫ਼ਤੇ ਜਾਂ ਦਸ ਬਾਰਾਂ ਦਿਨ ਲਈ ਠੰਢੀਆਂ ਇਲਾਕੇ ਜਿਵੇਂ ਕਿ ਸ਼ਿਮਲਾ ਮਕਲੋੜਗੰਜ ਅਤੇ ਹਿਮਾਚਲ ਵੱਲ ਜਾਣ ਦੇ ਪਲੈਨ ਬਣਾ ਲੈਂਦੇ ਹਨ ਅਤੇ ਯਾਤਰਾਵਾਂ ਕਰਦੇ ਹਨ ਤਾਂ ਜੋ ਉੱਥੇ ਜਾ ਕੇ ਉਨ੍ਹਾਂ ਨੂੰ ਉੱਥੇ ਦਾ ਆਨੰਦ ਉੱਥੇ ਜਾ ਕੇ ਆਨੰਦ ਮਾ ਸਕ ਆਨੰਦ ਮਾਣ ਸਕਣ ਅਤੇ ਉੱਥੇ ਦਾ ਨਜ਼ਾਰਾ ਲ ਲੈ ਸਕਣ ਅਤੇ ਉੱਥੇ ਦਾ ਜੋ ਮੌਸਮ ਦਾ ਆਨੰਦ ਮਾਣ ਸਕਣ ਅਤੇ ਜ਼ਿਆਦਾਤਰ ਲੋਕ ਠੰਢੀਆਂ ਥਾਵਾਂ 'ਤੇ ਜਾਣਾ ਪਸੰਦ ਕਰਦੇ ਹਨ